ਰੂਪਨਗਰ ਜ਼ਿਲ੍ਹੇ ਵਿੱਚ ਆਵਾਜਾਈ ਦੇ ਬਹੁਤ ਵੱਡੇ ਸਾਧਨ ਹਨ ਅਤੇ ਰੇਲਵੇ ਸਟੇਸ਼ਨ ਰੇਲ ਗੱਡੀਆਂ ਸਾਰੇ ਪਾਸੇ ਨੂੰ ਇੱਥੇ ਹਿਮਾਚਲ ਦਿੱਲੀ ਚੰਡੀਗੜ੍ਹ ਨੂੰ ਜਾਂਦੀਆਂ ਹਨ ਅਤੇ ਬੱਸਾਂ ਦਾ ਬਹੁਤ ਵਧੀਆ ਬੱਸ ਅੱਡਾ ਹੈ ਅਤੇ ਹ ਹਰ ਪਾਸੇ ਨੂੰ ਬੱਸਾਂ ਜਾਂਦੀਆ ਹਨ ਅਤੇ ਸਾਰਿਆਂ ਨੂੰ ਸਹੂਲਤਾਂ ਬਹੁਤ ਜ਼ਿਆਦਾ ਮਿਲਦੀਆਂ ਹਨ ਇਸ ਲੇਡੀ ਲਈ ਪੰਜਾਬ ਵਿੱਚ ਪੰਜਾਬ ਰੋਡਵੇਜ਼ ਵਿੱਚ ਸਫ਼ਰ ਫ੍ਰੀ ਹੈ ਅਤੇ ਸੜਕਾਂ ਵੀ ਰੋਪੜ ਜ਼ਿਲ੍ਹੇ ਦੀਆਂ ਬਹੁਤ ਵਧੀਆ ਹਨ ਅਤੇ ਦਿੱਕਤਾਂ ਕਈ ਵਾਰ ਇਸ ਕਰਕੇ ਪੈ ਜਾਂਦੀਆ ਜਿਵੇਂ ਰੈਲੀ ਧਰਨੇ ਹੋ ਜਾਂਦੇ ਹਨ ਉਸ ਕਰਕਾ ਵੀ ਸੜਕਾਂ ਬਲੋਕ ਹੋ ਜਾਂਦੀਆ ਹਨ ਅਤੇ ਬਾਕੀ ਤਾਂ ਬਹੁਤ ਵਧੀਆ ਇੱਥ ਰੋਪੜ ਜ਼ਿਲ੍ਹੇ ਤੋਂ ਜਾਣ ਲਈ ਸਾਧਨ ਹਨ